ਹਰ ਰਾਜ ਦੀ ਇੱਕ ਵੱਖਰੀ ਕਲਾਕਾਰੀ ਹੈ ਹਰ ਖੇਤਰ ਦੇ ਵਿੱਚ ਅਲ ਅਲੱਗ ਕਲਾਕਾਰੀ ਹੈ ਹਰ ਇੱਕ ਸ਼ਹਿਰ ਦੀ ਆਪਣੀ ਕਲਾਕਾਰੀ ਆ ਆਪਣੀ ਸ਼ਿਲਪਕਾਰੀ ਹੈ ਜਿਸ ਕਰਕੇ ਉਹ ਬਹੁਤ ਆਪਣੇ ਆਪਣੇ ਖੇਤਰ ਵਿੱਚ ਮਸ਼ਹੂਰ ਹੁੰਦੇ ਹਨ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੀ ਆਪਣੀ ਇੱਕ ਇੱਕ ਵਿਲੱਖਣ ਪਛਾਣ ਹੈ ਅੰਮ੍ਰਿਤਸਰ ਦੇ ਵਿਰਾਸਤੀ ਚਿੰਨ੍ਹ ਵਿਰਾਸਤੀ ਜਗ੍ਹਾ ਵੇਖਣ ਵਾਲੀਆਂ ਜਗ੍ਹਾ ਜਿਹੜੀਆਂ ਪੁਰਾਣੀਆਂ ਪੁਰਾਣੇ ਜ਼ਮਾਨੇ ਦੀਆਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀਆਂ ਜਿਹੜੀਆਂ ਜਗ੍ਹਾ ਨੇ ਉਹ ਇੱਕ ਆਪਣੀ ਵਿਲੱਖਣ ਪਛਾਣ ਰੱਖਦੀਆਂ ਹਨ ਸਾਡੇ ਖੇਤਰ ਵਿੱਚ ਇਹ ਜਿਹੜੀ ਕਲਾਕਾਰੀ ਅਤੇ ਸ਼ਿਲਪਕਾਰੀ ਹੈ ਅਲੱਗ ਅਲੱਗ ਛੋਟੀਆਂ ਛੋਟੀਆਂ ਇੱਟਾਂ ਦੇ ਨਾਲ ਬਣੀਆਂ ਇਮਾਰਤਾਂ ਜੋ ਹੋਰ ਕਿਸੇ ਵੀ ਸ਼ਹਿਰ 'ਚ ਵੇਖਣ ਨੂੰ ਨਹੀਂ ਮਿਲਦੀਆਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਬਣੀਆਂ ਹੋਈਆਂ ਜਗ੍ਹਾਵਾਂ ਨੇ ਅਤੇ ਕਲਾ ਦੇ ਖੇਤਰ ਵਿੱਚ ਜਿਵੇਂ ਪੰਜਾਬੀ ਲੋਕ ਨਾਚ ਭੰਗੜਾ ਹੈ ਗਿੱਧਾ ਹੈ ਇਹ ਇਸ ਖੇਤਰ ਦੇ ਵਿੱਚ ਬਹੁਤ ਮਸ਼ਹੂਰ ਨੇ ਇਹ ਆਪਣੀ ਇੱਕ ਵਿਲੱਖਣ ਪਛਾਣ ਰੱਖਦੇ ਨੇ ਸ਼ਾਇਦ ਹੀ ਕੋਈ ਵੀ ਸਮਾਗਮ ਹੋਵੇ ਕੋਈ ਸੱਭਿਆਚਾਰਕ ਸਮਗਾ ਸਮਾਗਮ ਹੋਵੇ ਕੋਈ ਮੇਲਾ ਹੋਵੇ ਕੋਈ ਤਿਉਹਾਰ ਹੋਵੇ ਜਿੱਥੇ ਇਹ ਇੱਕ ਕਲਾ ਨਾ ਦਿਖਾਈ ਜਾਂਦੀ ਹੋਵੇ ਗਿੱਧਾ ਜਾਂ ਭੰਗੜੇ ਦੀ ਕਲਾਕਾਰੀ ਨਾ ਦਿਖਾਈ ਜਾਂਦੀ ਹੋਵੇ ਭੰਗੜੇ ਦੀ ਕਲਾਕਾਰੀ ਅੱਜ ਕੱਲ੍ਹ ਹਰ ਕੋਲਜ ਦੇ ਵਿੱਚ ਹਰ ਯੂਨੀਵਰਸਿਟੀ ਦੇ ਵਿੱਚ ਹਰ ਪ੍ਰੋਗਰਾਮ ਦੀ ਸ਼ੁਰੂਆਤ ਅਤੇ ਅਖੀਰ ਸਮਾਪਤੀ ਲਈ ਇਸੇ ਦੇ ਨਾਲ ਹੀ ਕੀਤਾ ਜਾਂਦਾ ਹੈ ਇੱਕ ਅਲੱਗ ਹੀ ਪਛਾਣ ਰੱਖਦੇ ਹਨ ਇਹਨਾਂ ਦਾ ਵਿਰਾਸਤ ਵਿੱਚ ਬਹੁਤ ਹੀ ਯੋਗਦਾਨ ਹੈ ਸਾਡੇ ਵਿਰਾਸਤ ਦੀ ਇਹ ਇੱਕ ਵੱਖਰੀ ਪਛਾਣ ਹੈ